ਹੈਲੋ ਸਤਿ ਸ਼੍ਰੀ ਅਕਾਲ ਜੀ ਸਰ ਫਲਿਪਕਾਰਟ ਕੰਪਨੀ ਤੋ ਗੱਲ ਕਰ ਰਹੇ ਹੋ ਸਰ ਐਕਚੁਲੀ ਨਾ ਮੈਂ ਇੱਕ ਤੁਹਾਡੇ ਤੋਂ ਇੱਕ ਜੀਨ ਪਰਚੇਸ ਕੀਤੀ ਸੀਗੀ ਸਰ ਮੇਰਾ ਨਾਮ ਵਿਪਨ ਸ਼ਰਮਾ ਜੀ ਸਰ ਉਹਦਾ ਔਡਰ ਨੰਬਰ ਹੈਗਾ ਜੀ ਬਾਰਾਂ ਅਠਾਨਵੇਂ ਤੇਤੀ ਤਰਵੰਜਾ ਸਰ ਇੱਕ ਇਹ ਨਾ ਮੈਂ ਟੋਮੀ ਕੰਪਨੀ ਦੀ ਤੁਹਾਡੇ ਤੋਂ ਨਾ ਜੀਨ ਜਿਹੜੀ ਆ ਉਹ ਪਰਚੇਸ ਕੀਤੀ ਸੀਗੀ ਅਤੇ ਇਹਦੇ ਵਿਚ ਸਰ ਮਤਲਬ ਇੱਕ ਤਾਂ ਮੇਰੀ ਡਿਲੀਵਰੀ ਜਿਹੜੀ ਤੁਸੀਂ ਜੀਨ ਦੀ ਬਹੁਤ ਜ਼ਿਆਦਾ ਲੇਟ ਕੀਤੀ ਹੈ ਜੀ ਹਾਂਜੀ ਸਰ ਐਕਚੁਲੀ ਕਿਉਂਕਿ ਮੈਂ ਇਹ ਜਿਹੜੀ ਜੀਨ ਪਾਉਣੀ ਸੀ ਬਰਥਡੇ ਪਾਰਟੀ ਦੇ ਫਰੈਂਡ ਦੀ ਬਰਥਡੇ ਪਾਰਟੀ ਸੀ ਉੱਥੇ ਪਾਉਣੀ ਸੀਗੀ ਇਹ ਜੀਨ ਅਤੇ ਸਰ ਕੋਈ ਜੀਨ ਬਹੁਤ ਜ਼ਿਆਦਾ ਵਧੀਆ ਨਹੀਂ ਮਤਲਬ ਮੈਨੂੰ ਲੱਗੀ ਗੀ ਜਿਸ ਤਰ੍ਹਾਂ ਸਰ ਤੁਸੀਂ ਫੋਟੋ 'ਤੇ ਮਤਲਬ ਦਿਖਾ ਰਹੇ ਸੀ ਨਾ ਫਲਿਪਕਾਰਟ 'ਤੇ ਜਿਹੜਾ ਤੁਸੀਂ ਸਾਈਟ 'ਤੇ ਪਾਈ ਵੀਆਂ ਸੀ ਫੋਟੋਆਂ ਪਾਈਆਂ ਹੋਈਆਂ ਸੀ ਇਹਦੀਆਂ ਮਤਲਬ ਉਹ ਉਸ ਦੇ ਅਕੋਰਡਿੰਗ ਸਰ ਇਹ ਬਿਲਕੁਲ ਵੀ ਨਹੀਂ ਸੀ ਚੰਗੀ ਨਾ ਸਰ ਮੈਂ ਮਤਲਬ ਜਦੋਂ ਇਹ ਖੋਲ੍ਹੀ ਅਤੇ ਜੀਨ ਜਿਹੜੇ ਇਹਦੇ ਪੋਕਿਟ ਹੈ ਉਹਦੇ ਵਿੱਚ ਨਾ ਕਾਫ਼ੀ ਜਾਣੀ ਕਿ ਮੋਰੀਆਂ ਜ਼ਿਆਦਾ ਹੋਈਆਂ ਵੀਆਂ ਸੀਗੀਆਂ ਸਰ ਐਕਚੁਲੀ ਮੈਂ ਮਤਲਬ ਮੇਰੇ ਬਜਟ ਤੋਂ ਵੀ ਬਾਹਰ ਸੀ ਮੈਂ ਤਾਂ ਵੀ ਲਈ ਕਿਉਂਕਿ ਮੈਨੂੰ ਜ਼ਿਆਦਾ ਸੋਹਣੀ ਲੱਗੀ ਤੁਹਾਡੀ ਇਹ ਜੀਨ ਠੀਕ ਹੈ ਮੈਂ ਹੋ ਸਕਦਾ ਤੁਹਾਡੀ ਸਾਇਟ ਤੋਂ ਜਿਹੜਾ ਕਾਫ਼ੀ ਸਮਾਨ ਖਰੀਦਦਾ ਹੈ ਨਾ ਬਟ ਮੈਂ ਇਹ ਸਾਈਟ 'ਤੇ ਤੁਹਾਡੀ ਸਾਈਟ 'ਤੇ ਤਾਂ ਹੀ ਖਰੀਦਦਾ ਮਤਲਬ ਮੈਨੂੰ ਅੱਛੇ ਪ੍ਰੋਡਕਟ ਮਿਲਦੇ ਤੁਹਾਡੀ ਸਾਈਟ ਤੋਂ ਹੈ ਨਾ ਕਦੀ ਕੋਈ ਕੰਪਲੇਂਟ ਨਹੀਂ ਆਈ ਹੈਗੀ ਬਟ ਸਰ ਜਿਹੜੀ ਇਹ ਜੀਨ ਮੈਂ ਆਊਟ ਆਫ ਬਜਟ ਹੋ ਕੇ ਲਈ ਸੀ ਤੁਹਾਡੇ ਤੋਂ ਪਰ ਮਤਲਬ ਮੇਰੀ ਖੁਸ਼ੀ ਨਹੀਂ ਮਹਿਸੂਸ ਹੋਈ ਮੈਨੂੰ ਮਤਲਬ ਮੈਂ ਆਪਣੇ ਯਾਰਾਂ ਦੋਸਤਾਂ ਨੂੰ ਕਹਿ ਦਿੰਦਾ ਸੀ ਫਲਿਪਕਾਰਟ ਕੰਪਨੀ ਦੇ ਆਪਾਂ ਸਮਾਨ ਲੈਣਾ ਮਤਲਬ ਹੈ ਨਾ ਕੋਈ ਦਿੱਕਤ ਨਹੀਂ ਹੈ ਮਤਲਬ ਵਧੀਆ ਗੱਲ ਸੁਣਦੇ ਆ ਹੈ ਨਾ ਬਟ ਸਰ ਮੈਨੂੰ ਇਹ ਜਿਹੜੀ ਤੁਹਾਡੀ ਜੀਨ ਹੈ ਇਹ ਚੰਗੀ ਨਹੀਂ ਲੱਗੀ ਹੈਗੀ ਅਤੇ ਮਾਰੇ ਜਿਹੜੇ ਦੋਸਤ ਮਿੱਤਰ ਹੈਗੇ ਮੇਰੇ ਜਿਹਨਾਂ ਨੂੰ ਮੈਂ ਪਰਚੇਜ ਕਰਾਉਣਾ ਤੁਹਾਡੀ ਸਾਈਟ ਤੋਂ ਸਮਾਨ ਹੈ ਨਾ ਅਤੇ ਮਤਲਬ ਮੈਂ ਉਹਨਾਂ ਨੂੰ ਇਹ ਕਹਾਂ ਵੀ ਅੱਜ ਤੋਂ ਬਾਅਦ ਤੁਸੀਂ ਜਿਹੜਾ ਫਲਿਪਕਾਰਟ ਤੋਂ ਸਮਾਨ ਨਹੀਂ ਲੈਣਾ ਹੈਗਾ ਕਿਉਂਕਿ ਸਰ ਪਹਿਲੀ ਗੱਲ ਤਾਂ ਮੈਂ ਆਪਣੇ ਬਰਡੇ ਪਾਰਟੀ ਵਾਸਤੇ ਲਈ ਸੀ ਜੀਨ ਅਤੇ ਬਰਡੇ ਪਾਰਟੀ 'ਤੇ ਮੈਨੂੰ ਡਿਲੀਵਰ ਨਹੀਂ ਹੋਈ ਤਾਂ ਮੈਨੂੰ ਫਾਇਦਾ ਕੀ ਉਸ ਚੀਜ਼ ਦਾ ਇੰਨੇ ਪੈਸੇ ਲਾਉਣ ਦਾ ਜੇ ਬੰਦੇ ਨੂੰ ਸਮਾਨ ਹੀ ਸਹੀ ਪ੍ਰੋਪਰ ਟਾਈਮ 'ਤੇ ਨਾ ਮਿਲਿਆ ਫਿਰ ਫਾਇਦਾ ਹੀ ਨਹੀਂ ਨਾ ਸਰ ਕੋਈ ਜੀਨ ਮਤਲਬ ਉਹ ਕਰਨ ਦਾ ਇੰਨੇ ਪੈਸੇ ਵੀ ਲਾ ਤੇ ਮੈਨੂੰ ਚੀਜ਼ ਵੀ ਵਧੀਆ ਨਹੀਂ ਮਿਲੀ ਹੈਗੀ ਨਾ ਹੀ ਸਰ ਜਿੱਦਾਂ ਦਾ ਕਲਰ ਮੈਂ ਤੁਹਾਨੂੰ ਕਿਹਾ ਸੀਗਾ ਉਹ ਕਲਰ ਭੇਜਿਆ ਤੁਸੀਂ ਪਲੀਜ਼ ਤੁਸੀਂ ਮੇਰਾ ਜਿਹੜਾ ਇਹ ਨਹੀਂ ਤਾਂ ਮੈਂ ਤੁਹਾਡੇ 'ਤੇ ਸਾਈਟ 'ਤੇ ਨੈਗਟਿਵ ਅਤੇ ਨੈਗਟਿਵ ਰਿਵਿਊ ਕਰਾਂਗਾ ਜਿਹਦਾ ਮੇਰਾ ਜਿਹੜਾ ਸਮਾਨ ਹੈਗਾ ਮਤਲਬ ਤੁਸੀਂ ਜਲਦੀ ਤੋਂ ਜਲਦੀ ਇਹ ਰਿਟਰਨ ਉਹ ਕਰਕੇ ਅਤੇ ਮੈਨੂੰ ਜਿਹੜੇ ਟਰਾਂਜੈਕਸ਼ਨ ਆਈ ਡੀ ਮੇਰੇ ਖ਼ਾਤੇ 'ਚ ਜਿਹੜੇ ਪੈਸੇ ਪਾਏ ਦਿੱਤੇ ਜਾਣ ਧੰਨਵਾਦ ਸਰ